ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਖਾਲਸਾ ਡੈਅਰੀ 'ਚੋ ਬੋਲਦੇ ਹੋ ਅੱਛਾ ਜੀ ਅੱਛਾ ਠੀਕ ਆ ਜੀ ਅਸੀਂ ਵੀ ਗੋਵਿੰਦਗੜ੍ਹ ਤੋਂ ਬੋਲ ਰਹੇ ਸੀਗੇ ਹਾਂਜੀ ਸਾਨੂੰ ਤੁਹਾਡੇ ਪ੍ਰੋਡਕਟਾਂ ਬਾਰੇ ਪਤਾ ਲੱਗਿਆ ਸੀਗਾ ਤੁਹਾਡੇ ਵੀ ਪਨੀਰ ਵਗੈਰਾ ਮਿਲਦਾ ਇੱਥੇ ਹਾਂ ਜਿਸ ਤਰ੍ਹਾਂ ਘਿਓ ਘੂ ਖੋਆ ਸਾਰਾ ਕੁਛ ਕਹਿੰਦੇ ਤੁਹਾਡੇ ਡਾਇਰੀ ਤੋਂ ਮਿਲ ਰਿਹਾ ਹਾਂਜੀ ਹਾਂਜੀ ਸਾਡੇ ਵੀ ਸੀਗਾ ਇੱਕ ਫੰਕਸ਼ਨ ਸਾਨੂੰ ਜ਼ਰੂਰਤ ਸੀਗੀ ਹਾਂਜੀ ਸਾਡੇ ਪਿੰਡ ਤੁਹਾਡੇ ਰਿਸ਼ਤੇਦਾਰੀ ਆ ਕੋਈ ਕਿਸੇ ਦੇ ਉਹਨਾਂ ਨੇ ਸਾਨੂੰ ਤੁਹਾਡਾ ਨੰਬਰ ਦਿੱਤਾ ਸੀ ਹਾਂਜੀ ਸਾਨੂੰ ਉੱਥੋਂ ਪਤਾ ਲੱਗਿਆ ਸੀਗਾ ਫਿਰ ਤੁਸੀਂ ਸਾਨੂੰ ਕਿਸ ਕਿਸ ਰੇਂਜ 'ਚ ਦਉਂਗੇ ਘਿਓ ਵਗੈਰਾ ਜਿੱਦਾਂ ਪਨੀਰ ਠੀਕ ਆ ਜੀ ਠੀਕ ਆ ਫਿਰ ਅਸੀਂ ਕਹਿੰਦੇ ਤੁਹਾਨੂੰ ਫਿਰ ਦੁਬਾਰਾ ਕੰਡਕਟ ਕਰਾਂਗੇ ਫਿਰ ਘਰ ਮੈਂ ਸਲਾਹ ਕਰਕੇ ਤੁਹਾਨੂੰ ਵੀ ਕਿੰਨਾ ਕਿੰਨਾ ਸਾਨੂੰ ਘਿਉ ਚਾਹੀਦਾ ਕਿੰਨਾ ਸਾਨੂੰ ਖੋਆ ਪਨੀਰ ਵਗੈਰਾ ਜੋ ਵੀ ਪ੍ਰੋਡਕਟ ਸਾਨੂੰ ਚਾਹੀਦੇ ਫਿਰ ਤੁਹਾਨੂੰ ਦੱਸਾਂਗੇ ਅਸੀਂ ਹਾਂਜੀ ਹਾਂਜੀ ਇਸ ਨੰਬਰ 'ਤੇ ਕਾਲ ਕਰੀਏ ਅਸੀਂ ਠੀਕ ਹੈ ਜੀ ਨਹੀ ਅਸੀਂ ਇਹਨੂੰ ਫਿਰ ਅਸੀਂ ਤਾਰੀਕ ਵਗੈਰਾ ਦੱਸ ਦਾਂਗੇ ਵੀ ਕਿੰਨੀ ਤਰੀਕ ਨੂੰ ਲੈਣਾ ਅਸੀਂ ਕਿੱਦਣ ਫੰਕਸ਼ਨ ਆ ਸਾਡੇ ਜੀ ਤੁਸੀਂ ਡਿਲੀਵਰੀ ਵਗੈਰਾ ਸਾਡੇ ਘਰ ਕਰ ਦਉਂਗੇ ਠੀਕ ਆ ਜੀ ਠੀਕ ਆ ਚਲੋ ਕੋਈ ਨਾ ਮੈਂ ਤੁਹਾਨੂੰ ਸਲਾਹ ਕਰਕੇ ਫਿਰ ਇੱਕ ਦੋ ਦਿਨ 'ਚ ਕਾਲ ਕਰ ਦਿੰਦੇ ਹਾਂ ਅਸੀਂ ਹਾਂਜੀ ਹਾਂ ਠੀਕ ਆ ਜੀ ਹੋਰ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ